ਹਾਂਜੀ ਇਹ ਨਿਰਣਾ ਠੀਕ ਹੈ ਕਿ ਡਰਾਇਵਰ ਨਹੀਂ ਆ ਰਿਹਾ ਤਾਂ ਤ ਅਸੀਂ ਕੈਬ ਨੂੰ ਰੱਦ ਕਰ ਸਕਦੇ ਹਨ ਪਰ ਦੂਜੇ ਪਾਸੇ ਬਹੁਤ ਸਾਰੇ ਕਾਰਨ ਵੀ ਹੁੰਦੇ ਹਨ ਕਿਉਂਕਿ ਕਈ ਵਾਰ ਕੁਝ ਇੰਟਰਨੈੱਟ ਸੇਵਾਵਾਂ ਨਾ ਚੱਲ ਚੱਲਣ ਕਾਰਨ ਵੀ ਡਰਾਇਵਰ ਆਪਣੇ ਸਥਾਨ 'ਤੇ ਨਹੀਂ ਪਹੁੰਚ ਪਾਉਂਦੇ ਅਤੇ ਕੁਝ ਕਾਰ ਠੀਕ ਨਾ ਹੋਣ ਕਰਕੇ ਵੀ ਡਰਾਇਵਰ ਆਪਣੇ ਸਥਾਨ 'ਤੇ ਨਹੀਂ ਪਹੁੰਚ ਪਾਉਂਦੇ ਕਿਉਂਕਿ ਵੱਖ ਵੱਖ ਦੁੱਖ ਤਕਲੀਫ਼ਾਂ ਹੁੰਦੀਆਂ ਹਨ ਇਸ ਦੇ ਹਿਸਾਬ ਦੇ ਨਾਲ ਮੈਨੂੰ ਇਹ ਲਗਦਾ ਹੈ ਕਿ ਕੈਬ ਨੂੰ ਰੱਦ ਕਰਨਾ ਹੀ ਇੱਕ ਸੋਲੀਯੂਸ਼ਨ ਨਹੀਂ ਹੈ